ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਧਾਰਮਿਕ ਅੰਧ ਵਿਸ਼ਵਾਸਾਂ ਬਾਰੇ ਕੀ ਸੋਚਦਾ ਹਾਂ ਅਤੇ ਕੁਝ ਅੰਧ ਵਿਸ਼ਵਾਸ ਚੱਲ ਰਹੇ ਹਨ ਉਹਨਾਂ ਬਾਰੇ ਕੀ ਸੋਚਦਾ ਹਾਂ ਮੈਂ ਸੋਚਦਾ ਹਾਂ ਕਿ ਧਾਰਮਿਕ ਅੰਧ ਵਿਸ਼ਵਾਸ ਅੱਜ ਕੱਲ੍ਹ ਕੁਛ ਮਾਇਨੇ ਨਹੀਂ ਰੱਖਦੇ ਲੋਕਾਂ ਨੂੰ ਅੰਧ ਵਿਸ਼ਵਾਸਾਂ ਵਿੱਚ ਨਹੀਂ ਪੈਣਾ ਚਾਹੀਦਾ ਅੰਧ ਵਿਸ਼ਵਾਸ ਜੋ ਕਿ ਅੱਜ ਕੱਲ੍ਹ ਚੱਲ ਰਹੇ ਹਨ ਜਿਵੇਂ ਕਿ ਰਾਤ ਨੂੰ ਨਹੁੰ ਨਹੀਂ ਕੱਟਣਾ ਰਾਤ ਨੂੰ ਸਿਰ ਨਹੀਂ ਵਾਹੁਣਾ ਅਤੇ ਮੰਗਲਵਾਲ ਵਾਰੇ ਮੰਗਲਵਾਰ ਵਾਲੇ ਦਿਨ ਸਿਰ ਨਹੀਂ ਧੋਣਾ ਐਵੇਂ ਦੇ ਕੁਝ ਜਿਵੇਂ ਟੂਣੇ ਐਵੇਂ ਦੇ ਅੰਧ ਵਿਸ਼ਵਾਸ ਜੋ ਅੱਜ ਵੀ ਚੱਲ ਰਹੇ ਹਨ ਮੈਂ ਇਹਨਾਂ ਨੂੰ ਨਹੀਂ ਮੰਨਦਾ ਅਤੇ ਕਿਸੇ ਨੂੰ ਵੀ ਇਹ ਅੰਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਪਣੇ ਗੁਰੂ ਦੀ ਮੱਲ ਗੱਲ ਮੰਨਣੀ ਚਾਹੀਦੀ ਹੈ ਅਤੇ ਸ ਲ ਅਤੇ ਸਕੂਲਾਂ ਵਿੱਚ ਟੀਚਰਾਂ ਨੂੰ ਆਪਣੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹਨਾਂ ਨਾਲ ਕਿਵੇਂ ਨਜਿੱਠਿਆ ਜਾ ਸਕੇ ਉਹਨਾਂ ਨੂੰ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਬੱਚੇ ਆਪਣੇ ਘਰ ਜਾ ਕੇ ਵੀ ਦੱਸ ਸਕਣ ਕਿ ਐਵੇਂ ਦਾ ਕੁਝ ਨਹੀਂ ਹੁੰਦਾ ਅਤੇ ਆਪਣੇ ਬਜ਼ੁਰਗਾਂ ਦੀ ਪੁਰਾਣੀ ਪਿਛੜੀ ਹੋਈ ਸੋਚ ਨੂੰ ਅੱਗੇ ਵਧਾ ਸਕਣ ਵਿਦਿਆਰ ਵਿਦਿਆਰਥੀ ਆਪਣੇ ਟੀਚਰਾਂ ਨਾਲ ਮਿਲ ਕੇ ਬਹੁਤ ਹੀ ਵਧੀਆ ਹੱਲ ਕਰ ਸਕਦੇ ਹਨ ਧੰਨਵਾਦ